ਹੈਲੋ ਹੈਲੋ ਹਾਂਜੀ ਨਮਸਕਾਰ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਉਹੀ ਉਹੀ ਉਹੀ ਜੀ ਹਾਂਜੀ ਤੁਸੀਂ ਕੀ ਨਾਮ ਸੀਗਾ ਟੂਰ ਪੈਕ ਟੂਰ ਪੈਕ ਲੈਣਾ ਅੱਛਾ ਜੀ ਕਿੱਥੋਂ ਦਾ ਟੂਰ ਪੈਕ ਲੈਣਾ ਅੱਛਾ ਜੀ ਠੀਕ ਹੈ ਜੀ ਅਤੇ ਜੀ ਦਸ ਦਿਨ ਦਾ ਠੀਕ ਹੈ ਜੀ ਠੀਕ ਹੈ ਜਾਣਾ ਤੁਸੀਂ ਗੱਡੀ ਆਪਣੀ ਪਰਸਨਲ ਹੈ ਜਾਂ ਵਹੀਕਲ 'ਤੇ ਜਾਣਾ ਸਾਰੇ ਫੈਮਲੀ ਨੇ ਮਤਲਬ ਟੂਰ ਇੱਕ ਹੈਗੀ ਸਾਡੇ ਕੋਲ ਜੇ ਇੱਕ ਲੂਜਰ ਹੈਗੀ ਆ ਅਤੇ ਇੱਕ ਸਕਾਰਪਿਓ ਹੈਗੀ ਆ ਅਤੇ ਹੋਰ ਇੱਕ ਅੱਧੀ ਮਿਲ ਜੂਗੀ ਤੁਹਾਨੂੰ ਕੋਈ ਡਿਮਾਂਡ ਹੈਗੀ ਤਾਂ ਸਪੈਸ਼ਲ ਡਿਮਾਂਡ 'ਤੇ ਵੀ ਤੁਹਾਨੂੰ ਦੇ ਦਿਆਂਗੇ ਠੀਕ ਹੈ ਜੀ ਠੀਕ ਹੈ ਅਤੇ ਹਾਂਜੀ ਹਾਂਜੀ ਕਰ ਦਿਆਂਗੇ ਜੀ ਅ ਮਨਾਲੀ ਜੀ ਦੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਕਰ ਦਿਆਂਗੇ ਜੀ ਹਾਂਜੀ ਮੈਡਮ ਹੋ ਜੇਗਾ ਰਿਪਲੇਸ ਹਾਂ ਹੋ ਜੇਗਾ ਕੋਈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਦਸੰਬਰ ਠੀਕ ਹੈ ਡੇਟ ਦਸ ਦਿਓ ਥੋੜ੍ਹਾ ਵੀ ਡੇਟ ਕਿੰਨੀ ਡੇਟ ਨੂੰ ਮਤਲਬ ਜਾਣਾ ਠੀਕ ਹੈ ਜੀ ਪੰਜ ਦਸੰਬਰ ਇੱਕ ਵਾਰੀ ਕਰ ਰਿਹਾ ਅਤੇ ਉਸ ਤੋਂ ਬਾਅਦ ਤੁਸੀਂ ਅੱਗੇ ਪਿੱਛੇ ਕੋਈ ਇੱਕ ਦੋ ਦਿਨ ਦੀ ਡੇਟ ਕਰਾ ਵੀ ਸਕਦੇ ਹੋ ਠੀਕ ਹੈ ਜੀ ਅਤੇ ਉੱਥੇ ਰਹਿਣ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਕਰ ਦਿਆਂਗੇ ਜੀ ਅਤੇ ਖਾਣ ਪੀਣ ਦਾ ਵੀ ਹਾਂਜੀ ਹਾਂਜੀ ਉੱਥੋਂ ਦਾ ਤੁਹਾਨੂੰ ਸਭ ਗਾਈਡ ਦਿਆਂਗੇ ਨਾਲ ਤੁਹਾਨੂੰ ਮਨਾਲੀ ਦਾ ਚੰਗੀ ਤਰ੍ਹਾਂ ਵਿਜਿਟ ਕਰਾਵਾਂਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਜ਼ਰੂਰ ਗਾਈਡ ਨਾਲ ਦੇ ਦਿਆਂਗੇ ਅਤੇ ਉਸ ਦੇ ਨਾਲ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਹੋਲੀਡੇ ਇੰਜੋਏ ਕਰ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਮੈਡਮ ਠੀਕ ਹੈ ਜੀ ਠੀਕ ਓਕੇ